ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਫਿਰੋਜ਼ਪੁਰ ਜਿਹੜਾ ਪਿੰਡ ਹੈਗਾ ਉੱਥੇ ਦੇ ਰਹਿੰਦੇ ਰਹਿਣ ਵਾਲੇ ਹੋ ਅਤੇ ਤੁਸੀਂ ਕਿਹੜਾ ਕਿਹੜਾ ਉਗਾਉਂਦੇ ਹੈਗੇ ਗਰਮੀਆਂ ਦੇ ਸੀਜ਼ਨ 'ਚ ਅੱਛਾ ਸਬਜ਼ੀਆਂ ਕਿਹੜੀਆਂ ਕਿਹੜੀਆਂ ਜਿਵੇਂ ਅੱਛਾ ਠੀਕ ਆ ਇਹਨਾਂ ਦੇ ਫਾਇਦੇ ਫਿਰ ਕੀ ਕੀ ਹੋਣਗੇ

ਅੱਛਾ ਤੁਸੀਂ ਹਾਂ ਤੁਸੀਂ ਟਮਾਟਰ ਵਗੈਰਾ ਵੀ ਲਗਾਉਂਦੇ ਹੋ ਅੱਛਾ ਅਤੇ ਉਹਦੇ ਕੀ ਕੀ ਫਾਇਦੇ ਹੁੰਦੇ ਆ ਠੀਕ ਹੈ ਅਤੇ ਕੱਦੂ ਠੰਡਾ ਹੁੰਦਾ ਹੈ ਨਾ ਉਹ ਖਾਧਾ ਜਾ ਸਕਦਾ ਕਦੇ ਵੀ ਹਾਂ ਗਰਮੀ ਹੁੰਦੀ ਆ ਤਾਂ ਆਪਾਂ ਨੂੰ ਠੰਢਾ ਰੱਖਦਾ ਨਾ ਅੱਛਾ ਹਾਂ ਠੀਕ ਆ ਠੀਕ ਹੈ ਅਤੇ ਤੁਸੀਂ ਮੰਡੀ ਵਗੈਰਾ 'ਚ ਵੇਚਦੇ ਹੋ ਕਿ ਉਵੇਂ ਗਲੀ ਗਲੀ ਜਾ ਕੇ ਵੇਚਦੇ ਹੋ ਸਬਜ਼ੀਆਂ ਅੱਛਾ ਲੋਕਲ ਮੰਡੀ ਜਾਂਦੇ ਹੋ ਉੱਥੋਂ ਫਿਰ ਉੱਥੇ ਜਾਂਦੇ ਹੋ ਲੋਕਲ ਮੰਡੀ ਜਾਂਦੇ ਹੋ ਤੁਸੀਂ ਅੱਛਾ ਠੀਕ ਆ ਅੱਛਾ ਖਾਣ ਨੂੰ ਵੀ ਤੋਰੀਆਂ ਚਾਹੀਦੀਆਂ ਸੀਗੀਆਂ ਸਾਨੂੰ ਤੋਰੀਆਂ ਚਾਹੀਦੀਆਂ ਸੀਗੀਆਂ ਅੱਛਾ ਉਵੇਂ ਤੋਰੀਆਂ ਵੈਸੇ ਇਸ ਵਾਰੀ ਘੱਟ ਮਿਲੀਆਂ ਸੀਗੀਆਂ ਨਾ ਇਸ ਵਾਰੀ ਘੱਟ ਹੈਗੀਆਂ ਤਾਂ ਘੱਟ ਹੀ ਮਿਲਦੀਆਂ ਪਈਆਂ ਠੀਕ ਆ